ਅੰਮ੍ਰਿਤਸਰ ਵਿੱਚ ਲਗਭਗ ਸਾਰੇ ਹੀ ਆਵਾਜਾਈ ਦੇ ਸਾਧਨ ਹਨ ਜਿਵੇਂ ਰੇਲ ਯਾਤਰਾ ਹਵਾਈ ਯਾਤਰਾ ਆਟੋ ਰਿਕਸ਼ਾ ਬੱਸ ਜਾਂ ਖੁਦ ਦੇ ਸਾਧਨ ਹੋ ਗਏ ਜਿਵੇਂ ਬਾਈਕ ਸਕੂਟਰ ਰਿਕਸ਼ਾ ਸੈਕਟਰਾਂ ਬਾਈਕ ਸਕੂਟਰ ਸਾਈਕਲ ਐਟਸੈਕਟਰਾ ਵਗੈਰਾ ਵਗੈਰਾ ਲੇਕਿਨ ਆਮ ਤੌਰ 'ਤੇ ਆਮ ਆਦਮੀ ਅਗਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾਣਾ ਚਾਹੁੰਦਾ ਹੈ ਤੋ ਸਰਕਾਰੀ ਵਿਕਲਪ ਚੁਣੇਗਾ ਜਿਸ 'ਤੇ ਘੱਟ ਤੋਂ ਘੱਟ ਖਰਚਾ ਹੋਏਗਾ ਕਿਉਂਕਿ ਆਮ ਆਦਮੀ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹ ਛੋਟੀ ਜਿਹੀ ਦੂਰੀ ਨੂੰ ਵੀ ਤੈਅ ਕਰਨ ਲਈ ਟੈਕਸੀ ਵਗੈਰਾ ਬੁੱਕ ਕਰੇ ਤਾਂ ਜੇਕਰ ਹੁਣ ਮੈਨੂੰ ਕਿਤੇ ਨੇੜੇ ਤੇੜੇ ਦੀ ਜਗ੍ਹਾ 'ਤੇ ਜਾਣਾ ਵਾ ਤਾਂ ਮੈਂ ਪਹਿਲੇ ਆਟੋ ਰਿਕਸ਼ਾ ਦਾ ਇਸਤੇਮਾਲ ਕਰਾਂਗੀ ਆਟੋ ਰਿਕਸ਼ੇ ਤੋਂ ਮੈਂ ਬੱਸ ਅੱਡੇ ਜਾਵਾਂਗੀ ਬਸ ਅੱਡੇ ਤੋਂ ਮੈਂ ਸਰਕਾਰੀ ਬੱਸ ਲਵਾਂਗੀ ਤਾਂ ਕਿ ਮੈਂ ਆਪਣੀ ਡੈਸਟੀਨੇਸ਼ਨ ਜਿੱਥੇ ਮੈਂ ਪਹੁੰਚਣਾ ਚਾਹੁੰਦੀ ਮੈਂ ਉੱਥੇ ਪਹੁੰਚ ਜਾਵਾਂ ਇਸ ਤੋਂ ਵੀ ਵੱਧ ਸਰਕਾਰ ਨੇ ਆਮ ਆਦਮੀ ਔਰਤਾਂ ਵਾਸਤੇ ਔਰਤਾਂ ਲਈ ਇੱਕ ਬਹੁਤ ਹੀ ਸੁਵਿਧਾਜਨਕ ਗੱਲ ਕੀਤੀ ਹੈ ਕਿ ਉਹ ਆਧਾਰ ਕਾਰਡ ਨਾਲ ਬ ਆਹ ਸਰਕਾਰੀ ਬੱਸਾਂ ਦਾ ਸਫ਼ਰ ਕੀ ਹੈ ਮੁਫ਼ਤ ਕਰ ਦਿੱਤਾ ਗਿਆ ਹੈ ਜਿਸ ਨਾਲ ਔਰਤਾਂ ਕਿੱਥੇ ਵੀ ਅਸਾਨੀ ਨਾਲ ਬਿਨਾਂ ਕਿਸੇ ਖਰਚੇ ਦੇ ਜਾ ਸਕਦੀਆਂ ਹਨ ਆਮ ਆਦਮੀ ਦੇ ਹਰ ਆਦਮੀ ਲਈ ਵਿਕਲਪ ਚੁਣਨਾ ਚੁਣਨ ਲਈ ਅਸੀਂ ਹਵਾਈ ਯਾਤਰਾ ਦਾ ਤਾਂ ਕੋ ਹਵਾਈ ਯਾਤਰਾ ਦਾ ਤਾਂ ਕੋਈ ਵੀ ਨਾਮ ਨਹੀਂ ਲਵਾਂਗੀ ਕਿਉਂਕਿ ਉਹ ਉਸਦੇ ਬਜਟ ਤੋਂ ਵੀ ਬਾਹਰ ਹੁੰਦਾ ਹੈ ਇਸ ਲਈ ਜੇਕਰ ਉਸਨੇ ਜ਼ਿਆਦਾ ਦੂਰੀ 'ਤੇ ਜਾਣਾ ਹੈ ਤਾਂ ਉਹ ਰੇਲਵੇ ਰੇਲ ਯਾ ਯਾਤਰਾ ਦਾ ਇਸਤੇਮਾਲ ਕਰ ਸਕਦਾ ਹੈ ਅਤੇ ਜੇ ਕੋਈ ਘੱਟ ਦੂਰੀ ਹੈ ਤਾਂ ਉਸ ਨੂੰ ਬਸ ਯਾਤਰਾ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ ਬਸ ਯਾਤਰਾ ਵਿੱਚ ਵੀ ਉਹ ਸਰਕਾਰੀ ਬੱਸਾਂ ਦਾ ਸਰਕਾਰੀ ਬੱਸਾਂ ਦਾ ਯੁਜ਼ ਜ਼ਿਆਦਾ ਕਰਕੇ ਪ੍ਰਾਈਵੇਟ ਤਾਂ ਘੱਟ ਕਰਕੇ ਆਪਣੇ ਪੈਸਿਆਂ ਦੀ ਬੱਚਤ ਕਰ ਸਕਦਾ ਹੈ ਜਿਸ ਨਾਲ ਉਸਨੂੰ ਕਾਫ਼ੀ ਮਦਦ ਮਿਲੇਗੀ